ਹਾਂਜੀ ਸੋਨੂੰ ਡਰਾਈਵਰ ਬੋਲਦੇ ਪਏ ਜੀ ਹਾਂਜੀ ਭਾਅ ਜੀ ਮੈਂ ਨਾ ਕੈਬ ਬੁੱਕ ਕੀਤੀ ਸੀ ਗੋਲਡਨ ਟੈਂਪਲ ਜਾਣ ਵਾਸਤੇ ਅਤੇ ਕਾਫ਼ੀ ਟਾਈਮ ਹੋ ਗਿਆ ਹੈ ਅਤੇ ਤੁਸੀਂ ਆਏ ਨਹੀਂ ਮੈਂ ਤਾਂ ਵੇਟ ਕਰ ਰਹੀ ਹਾਂ ਤੁਹਾਡੀ ਹਾਂਜੀ ਹਾਂਜੀ ਭਾਅ ਜੀ ਮੈਂ ਆਪਣੇ ਗੇਟ ਦੇ ਬਾਹਰ ਹੀ ਖੜ੍ਹੀ ਹਾਂ ਤੁਸੀਂ ਮੈਨੂੰ ਦੱਸੋ ਤੁਸੀਂ ਕਿੱਥੇ ਕੁ ਪਹੁੰਚੇ ਹੋ ਭਾਅ ਜੀ ਨਿਰੰਕਾਰੀ ਕਲੋਨੀ ਦੇ ਤਿੰਨ ਗੇਟ ਨੇ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਮੈਨੂੰ ਲੱਗਦਾ ਹੈ ਤੁਸੀਂ ਗਲਤੀ ਨਾਲ ਦੋ ਨੰਬਰ 'ਚ ਆਉਣਾ ਸੀ ਤੁਸੀਂ ਕਿਸੇ ਹੋਰ ਨੰਬਰ 'ਚ ਚਲੇ ਗਏ ਹੋ ਨਹੀਂ ਨਹੀਂ ਭਾਅ ਜੀ ਤੁਸੀਂ ਉੱਧਰੋਂ ਬਾਹਰ ਆਓ ਅਤੇ ਬਾਹਰ ਸ਼ੋਪਸ ਹੈਗੀਆਂ ਨੇ ਸਾਡੇ ਕਲੋਨੀ ਦੇ ਬਾਹਰ ਤੁਸੀਂ ਉਹਨਾਂ ਨੂੰ ਉਹ ਉੱਧਰੋਂ ਆਓ ਅੰਦਰ ਅਤੇ ਉਸ ਤੋਂ ਬਾਅਦ ਤੁਸੀਂ ਰਾਈਟ ਮੁੜ ਜਾਣਾ ਹੈ ਨਹੀਂ ਨਹੀਂ ਨਹੀਂ ਭਾਅ ਜੀ ਉਹ ਤੋਂ ਤੁਸੀਂ ਬਾਹਰ ਨਿਕਲ ਕੇ ਫਿਰ ਤੁਹਾਨੂੰ ਰਸਤਾ ਪਤਾ ਲੱਗਣਾ ਜੀ ਇਸ ਤਰ੍ਹਾਂ ਨਹੀਂ ਪਤਾ ਲੱਗਣਾ ਦੇਖੋ ਮੈਂ ਨਾ ਲੇਟ ਹੋ ਰਹੀ ਹਾਂ ਪਲੀਜ ਜਰਾ ਜਲਦੀ ਕਰੋ ਹਾਂਜੀ ਹਾਂਜੀ ਹਾਂਜੀ ਬਾਹਰ ਬਾਹਰ ਆ ਗਏ ਹੋ ਬਾਹਰ ਆ ਗਏ ਹੋ ਤਾਂ ਤੁਸੀਂ ਰਾਈਟ ਆ ਕੇ ਅਤੇ ਸਿੱਧਾ ਆਈ ਜਾਓ ਅੰਦਰ ਉੱਥੇ ਗੇਟ ਨੰਬਰ ਦੋ ਲਿਖਿਆ ਹੋਏਗਾ ਵੱਡਾ ਵੱਡਾ ਨਿਰੰਕਾਰੀ ਕਲੋਨੀ ਗੇਟ ਨੰਬਰ ਦੋ ਹਾਂਜੀ ਹਾਂਜੀ ਬਾਹਰ ਸਬਜ਼ੀ ਵਾਲਾ ਹੋਊਗਾ ਇੱਕ ਦੋ ਦੁਕਾਨਾਂ ਹੋਰ ਹੋਣਗੀਆਂ ਦੇਖੋ ਜਰਾ ਹਾਂਜੀ ਹਾਂਜੀ ਦਿੱਖ ਗਈਆਂ ਨੇ ਅੱਛਾ ਤੁਸੀਂ ਉਸ ਤੋਂ ਹੁਣ ਸਿੱਧਾ ਹੀ ਅੰਦਰ ਆਓ ਹਾਂਜੀ ਹਾਂਜੀ ਫਿਰ ਤੁਸੀਂ ਲੈਫਟ ਮੁੜਨਾ ਜੀ ਥੋੜ੍ਹੀ ਜਿਹੀ ਅੱਗੇ ਆਓ ਪਹਿਲਾਂ ਥੋੜ੍ਹੀ ਜਿਹੀ ਅੱਗੇ ਆਓ ਹਾਂਜੀ ਹੁਣ ਲੈਫਟ ਮੁੜੋ ਨਹੀਂ ਲੈਫਟ ਤੋਂ ਬਾਅਦ ਤੁਸੀਂ ਕਿਤੇ ਨਹੀਂ ਮੁੜਨਾ ਸਿੱਧੇ ਉਸ ਤੋਂ ਬਾਅਦ ਇੱਕ ਪਾਰਕ ਆਏਗਾ ਉਸ ਤੋਂ ਬਾਅਦ ਸਿੱਧਾ ਆ ਜਿਓ ਤੀਹ ਨੰਬਰ ਮੈਂ ਬਾਹਰ ਹੀ ਖੜ੍ਹੀ ਹੋਵਾਂਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਮੈਨੂੰ ਤੁਹਾਡੀ ਗੱਡੀ ਦਿੱਖ ਗਈ ਹੈ ਅਤੇ ਤੁਸੀਂ ਆਓ ਸਿੱਧੇ ਆ ਜੋ ਮੈਂ ਬਾਹਰ ਹੀ ਖੜ੍ਹੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ